ਭੰਗੜਾ ਐਰੋਬਿਕਸ ਵਿਚ ਦੂਸਰੇ ਡਾਂਸਾਂ ਨਾਲੋਂ ਬੜਾ ਬਹੁਤ ਵਧੀਆ ਹੈ ਜਿਹੜਾ ਕਿ ਸਾਡੇ ਸਰੀਰ ਨੂੰ ਲਚਕਦਾਰ ਕਰਦਾ ਹੈ ਅਤੇ ਫਿਟਨਸ ਵੀ ਦਿੰਦਾ ਹੈ ਅੱਜ ਦੇ ਜਮਾਨੇ ਦੇ ਅਨੁਸਾਰ ਭੰਗੜਾ ਐਰੋਬਿਕਸ ਦੀ ਗਾਣਿਆਂ ਦੀ ਆਵਾਜ਼ ਉੱਚੀ ਹੁੰਦੀ ਹੈ ਤੇ ਉਹਦੇ ਉੱਤੇ ਭੰਗੜਾ ਐਰੋਬਿਕਸ ਕਰਨ ਦਾ ਬੜਾ ਹੀ ਮਜਾ ਆਉਂਦਾ ਹੈ ਅੱਜ ਦੇ ਬੱਚੇ ਪਹਿਲੇ ਭੰਗੜੇ ਨਾਲੋਂ ਇਹ ਭੰਗੜਾ ਪਸੰਦ ਬਹੁਤ ਕਰਦੇ ਹਨ ਅਤੇ ਮੇਰੀਆਂ ਦੋਤੀਆਂ ਵੀ ਇਸ ਭੰਗੜੇ ਨੂੰ ਮੈਨੂੰ ਕਹਿੰਦੀਆਂ ਨੇ ਕਰਿਆ ਕਰ ਨਾਨੀ ਤੂੰ ਵੀ ਫਿਟ ਹੋ ਜਾਵੇਗੀ ਕਿਉਂਕਿ ਮੇਰਾ ਥੋੜਾ ਜਿਹਾ ਸਰੀਰ ਭਾਰੀ ਹੈ ਤੇ ਕਹਿੰਦੀ ਹੌਲੀ ਹੌਲੀ ਕਰਿਆ ਕਰ ਅੱਜ ਕੱਲ ਦੀਆਂ ਔਰਤਾਂ ਭੰਗੜਾ ਐਰੋਬਿਕਸ ਦੀਆਂ ਕਲਾਸਾਂ ਵਿੱਚ ਜਾਂਦੀਆਂ ਨੇ ਤੇ ਫਿਰ ਭੰਗੜਾ ਐਰੋਬਿਕਸ ਕਰਦੀਆਂ ਨੇ ਤੇ ਕਰਕੇ ਆਪਣੇ ਸਰੀਰ ਨੂੰ ਫਿਟ ਰਸ ਦਿੰਦੀਆਂ ਨੇ ਅੱਜ ਕੱਲ ਦਾ ਜਮਾਨਾ ਖੂਬਸੂਰਤੀ ਦਾ ਹੈ ਤੇ ਆਪਣੇ ਆਪ ਨੂੰ ਖੂਬਸੂਰਤ ਬਣਾਉਂਦੀਆਂ ਹਨ ਭੋਗੜਾ ਕਰਕੇ ਆਪਣੀ ਆਪਣੀ ਸਰੀਰ ਦੀ ਲੋਚ ਨੂੰ ਫੁਰਤੀਲਾ ਸਰੀਰ ਨੂੰ ਫਰ ਫਰਤੀਲਾ ਕਰਦੀਆਂ ਹਨ ਤੇ ਭੱਜ ਭੱਜ ਕੇ ਕੰਮ ਕਰਦੀਆਂ ਹਨ ਭੰਗੜਾ ਬਹੁਤ ਮੇਰੇ ਅਨੁਸਾਰ ਭੰਗੜਾ ਬਹੁਤ ਹੀ ਔਰਬਿਕਸ ਭੰਗੜਾ ਬਹੁਤ ਹੀ ਵਧੀਆ ਡਾਂਸ ਹੈ ਧਨਵਾਦ